ਤਕਨੋਲਜੀ ਵਿੱਚ ਤਰੱਕੀ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਆਸਾਨ ਬਣਾ ਲਿਆ ਹੈ ਜਿਵੇਂ ਅਸੀਂ ਦੇਖਦੇ ਹਾਂ ਵਿਗਿਆਨ ਅਤੇ ਟੈਕਨੋਲਜੀ ਦਾ ਵਿਕਾਸ ਹੋਇਆ ਸਾਡੇ ਜੀਵਨ ਸ਼ੈਲੀ ਜਿਹੜੀ ਤਬਦੀਲੀਆਂ ਬਹੁਤ ਆਈਆਂ ਨੇ ਜਿਹਦੇ ਨਾਲ ਸਾਨੂੰ ਜਮੀਨ ਜੀਣਾ ਆਸਾਨ ਹੋ ਗਿਆ ਸਾਡੀ ਆਮ ਵਰਤੋ ਦੀਆਂ ਚੀਜ਼ਾਂ ਬਹੁਤ ਸੌਖੀਆਂ ਹੋ ਗਈਆਂ ਹਨ ਪਹਿਲੇ ਟਾਈਫ ਟੈਲੀਫੋਨ ਤੋਂ ਪਹਿਲੀ ਮੈਡੀਕਲ ਦਵਾਈ ਤੱਕ ਹਰ ਕਾਂਡ ਤੇ ਨਵੀਨਤਾ ਨੇ ਦੁਨੀਆਂ ਭਰ ਦੇ ਜੀਵਨ ਸ਼ੈਲੀ ਨੂੰ ਕਾਫੀ ਪ੍ਰਭਾਵਿਤ ਕੀਤਾ ਅਤੇ ਇਹ ਨਵੀਂ ਗੱਲ ਇੰਟਰਨੈਟ ਤੇ ਵੀ ਲਾਗੂ ਹੁੰਦੀ ਹੈ ਜਦੋਂ ਤੋਂ ਉੱਨੀ ਸੋ ਪੰਜਾਹ ਦੇ ਦਹਾਕੇ ਦੇ ਅਖੀਰ ਵਿੱਚ ਪਹਿਲਾਂ ਇੰਟਰਨੈਟ ਰੱਖਿਆ ਗਿਆ ਵਰਲਡ ਵਾਈਡ ਵੈੱਬ ਦੀ ਸ਼ਕਤੀ ਦੇ ਕਾਰਨ ਸੰਸਾਰ ਵਿੱਚ ਤਬਦੀਲੀਆਂ ਦੇ ਸਮੁੰਦਰ ਵਿੱਚ ਗੁਜਰਿਆ ਬੁਨਿਆਦੀ ਲੋੜਾਂ ਤੋਂ ਲੈ ਕੇ ਅਤਿਅੰਤ ਬਿਲਾਸਤਾਵਾਂ ਤੱਕ ਸਾਡੇ ਜੀਵਨ ਸ਼ੈਲੀ ਲਗਭਗ ਹਰ ਪਹਿਲੂ ਹੁਣ ਇੰਟਰਨੈਟ ਦੁਆਰਾ ਹੀ ਪ੍ਰਭਾਵਿਤ ਹੋਇਆ ਅਸੀਂ ਭਵਿੱਖ ਵੱਲ ਜਾਂਦੇ ਹਾਂ ਇੰਟਰਨੈਟ ਤੇ ਨਿਰਭਰ ਹੁੰਦੇ ਹਾਂ ਕਿਉਂਕਿ ਇਹ ਟੈਕਨੋਲਜੀ ਦਾ ਹੀ ਇੱਕ ਹਿੱਸਾ ਹ ਇੰਟਰਨੈੱਟ ਤੋਂ ਬਿਨਾਂ ਅੱਜ ਸਾਡੀ ਜ਼ਿੰਦਗੀ ਅਧੂਰੀ ਸਾਨੂੰ ਜਾਪਦੀ ਹੈ ਜੇਕਰ ਇੰਟਰਨੈਟ ਅੱਜ ਵੀ ਲੁਕ ਜਾਵੇ ਤਾਂ ਸਾਨੂੰ ਜੀਣਾ ਮੁਸ਼ਕਿਲ ਹੋ ਜਾਵੇਗਾ ਭਾਵੇਂ ਕਿ ਜ਼ਿੰਦਗੀ ਦਾ ਕੰਮ ਤਾਂ ਚੱਲੀ ਜਾਉਗੇ ਪਰ ਇਹਦੇ ਨਾਲ ਸਾਡੀ ਜਿਹੜੀ ਜੀਣਾ ਆਸਾਨ ਹੋ ਗਿਆ ਹੈ ਇਹਦੇ ਨਾਲ ਅਸੀਂ ਕਲਪਨਾ ਵੀ ਕਰ ਨਹੀਂ ਸਕਦੇ ਜਿਵੇਂ ਸਾਡੇ ਡੇਲੀ ਰੂਟੀਨ ਦੇ ਕੰਮ ਛੇਤੀ ਤੋਂ ਛੇਤੀ ਹੋ ਜਾਂਦੇ ਹਨ ਇਹਨਾਂ ਵਿੱਚੋਂ ਕੰਪਿਊਟਰ ਰਾਹੀਂ ਇੱਕ ਮੰਨ ਲੋ ਟੈਕਨੋਲੋਜੀ ਦਾ ਸਾਧਨ ਇਹਦਾ ਸਾਰੀ ਦੁਨੀਆਂ ਭਰ ਦੇ ਕਾਰੋਬਾਰ ਕੀਤੇ ਜਾਂਦੇ ਆ ਤੇ ਇੰਟਰਨੈਟ ਤੇ ਇਹ ਸੰਭਵ ਕਰ ਦਿੱਤਾ ਹੈ ਨਾ ਸਾਡੇ ਕੋਲ ਜੇ ਕੰਪਿਊਟਰ ਨਾਲ ਇੰਟਰਨੈੱਟ ਅਟੈਚ ਹੋਊਗਾ ਅਸੀਂ ਸਾਰਾ ਵਪਾਰ ਸੋਖਾ ਕਰ ਸਕਦੇ ਆਂ ਕਾਰੋਬਾਰਾਂ ਨੂੰ ਆਸਾਨ ਕਰ ਦਿੱਤਾ ਵੀ ਸਾਨੂੰ ਬਿਲ ਕਰਨ ਲਈ ਤੇ ਪੇ ਕਰਨ ਲਈ ਮੇਲ ਰਾਹੀ ਸੁਨੇਹੇ ਭੇਜਣ ਲਈ